ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦੇ ਮੌਕੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਭਾਰਤ ਦੇ ਵਿੱਚ ਅੱਜ ਭ੍ਰਿਸ਼ਟਾਚਾਰ ਬਹੁਤ ਹੀ ਵੱਧ ਚੁੱਕਾ ਹੈ ਜਿਸ ਕਰਕੇ ਸਿਰਫ਼ ਉਹੀ ਬੰਦਾ ਅੱਗੇ ਵੱਧ ਰਿਹਾ ਹੈ ਜਿਸਦੇ ਕੋਲ ਪੈਸਾ ਹੈ ਜੋ ਕਿ ਰਿਸ਼ਵਤ ਦੇ ਕੇ ਆਪਣਾ ਕੰਮ ਕਰਾ ਰਿਹਾ ਹੈ ਜਿਸ ਕਰਕੇ ਕੁਝ ਲੋਕ ਪਿੱਛੇ ਰਹਿ ਰਹੇ ਹੈ ਜਿਨ੍ਹਾਂ ਦੇ ਕੋਲ ਪੈਸਿਆਂ ਦੀ ਕਮੀ ਹੈ ਇਸ ਦੇ ਕਾਰਨ ਕਾਫ਼ੀ ਸਮੱਸਿਆਵਾਂ ਅੱਗੇ ਆ ਰਹੀਆਂ ਹਨ ਕਿ ਭਾਰਤ ਨੂੰ ਸਹੀ ਲੋੜੀਂਦੇ ਕਲਾਕਾਰ ਨਹੀਂ ਮਿਲ ਰਹੇ